ਪੰਜਾਬੀ ਭਾਸ਼ਾ ਨੇ ਕੀ ਹੈ ਹੋਰ ਭਾਸ਼ਾਵਾਂ ਦੇ ਖੇਤਰ ਦੇ ਵਿਕਾਸ ਵਿੱਚ ਬਹੁਤ ਜ਼ਿਆਦਾ ਮਤਲਬ ਕਿ ਪ੍ਰਭਾਵ ਪਾਇਆ ਜਿਵੇਂ ਕਿ ਆਪਾਂ ਨੂੰ ਪਤਾ ਹੀ ਆ ਹਾਰੇ ਇੱਕ ਛੋਟਾ ਬੱਚਾ ਵੀ ਆਪਣੀ ਮਾਤ ਭਾਸ਼ਾ ਦੇ ਕੀ ਆ ਉਹ ਨੇੜੇ ਹੁੰਦਾ ਜਿਹਦੇ ਕਾਰਨ ਕੀ ਆ ਉਹ ਉਹਦੇ ਛੋਟੇ ਛੋਟੇ ਵਰਡ ਨੂੰ ਜਾਂ ਬਹੁਤ ਔਖੇ ਔਖੇ ਸ਼ਬਦਾਂ ਨੂੰ ਵੀ ਕੀ ਆ ਆਸਾਨੀ ਨਾਲ ਸਿੱਖ ਜਾਂਦਾ ਕਿਉਂਕਿ ਉਹਦੀ ਮਾਤ ਭਾਸ਼ਾ ਹੁੰਦੀ ਆ ਓਸੇ ਤਰ੍ਹਾਂ ਕੀ ਹੈ ਮਾਤ ਭਾਸ਼ਾ ਜਿਵੇਂ ਮਾਂ ਇੱਕ ਬਾਕੀ ਭਾਸ਼ਾ ਮ ਮਾਂ ਇੱਕ ਭਾਸ਼ਾ ਨੂੰ ਸਿਖ ਸਿੱਖਣ ਵਿੱਚ ਮਦਦ ਕਰਦੀ ਆ ਉਵੇਂ ਕੀ ਆ ਪੰਜਾਬੀ ਸਾਡੀ ਮਾਤ ਭਾਸ਼ਾ ਹੈ ਉਹ ਵੀ ਸਾਨੂੰ ਦੂਸਰੀਆਂ ਭਾਸ਼ਾਵਾਂ ਨੂੰ ਸਿੱਖਣ ਵਿੱਚ ਮਦਦ ਕਰਦੀ ਹੈ ਜਿਵੇਂ ਕਿ ਅਕਸਰ ਅਸੀਂ ਪੰਜਾਬੀ ਤੋਂ ਪੰਜਾਬੀ ਸਿੱਕ ਪੰਜਾਬੀ ਸਾਨੂੰ ਪ੍ਰੋਪਰ ਆਉਂਦੀ ਹੁੰਦੀ ਆ ਅਸੀਂ ਇੰਗਲਿਸ਼ ਸਿੱਖਣ ਦੀ ਕੋਸ਼ਿਸ਼ ਕਰਦੇ ਹਾਂ ਤਾਂ ਅਸੀਂ ਨਾਲ ਨਾਲ ਉਹਦੀ ਟਰਾਂਸਲੇਸ਼ਨ ਕਰਕੇ ਪੰਜਾਬੀ ਦੇ ਵਿੱਚ ਸਮਝਦੇ ਹਾਂ ਸਿੱਖਦੇ ਹਾਂ ਅਤੇ ਉਹਨੂੰ ਕੀ ਹੈ ਲਰਨ ਕਰਦੇ ਹਾਂ ਮਤਲਬ ਉਹਦੇ ਹਰੇਕ ਮਤਲਬ ਉਹਦੇ ਹਰੇਕ ਪੱਖ ਨੂੰ ਆਪਾਂ ਆਸਾਨੀ ਨਾਲ ਸਿੱਖ ਜਾਂਦੇ ਹਾਂ ਜਦੋਂ ਸਾਨੂੰ ਆਪਣੀ ਪੰਜਾਬੀ ਭਾਸ਼ਾ ਜਾਂ ਸਾਨੂੰ ਆਪਣੀ ਮਾਤ ਭਾਸ਼ਾ ਆਉਂਦੀ ਹੁੰਦੀ ਹੈ ਇਵੇਂ ਕੀ ਹੈਗਾ ਪੰਜਾਬੀ ਭਾਸ਼ਾ ਨੇ ਸਾਨੂੰ ਹਰੇਕ ਭਾਸ਼ਾ ਨੂੰ ਸਿੱਖਣ ਵਿੱਚ ਸਾਡੀ ਕੀ ਹੈ ਮਦਦ ਕੀਤੀ ਹੈ